ਵੱਖ ਵੱਖ ਮੌਸਮ ਸਥਿਤੀਆਂ ਵਿੱਚ ਦੌੜਨ ਲਈ ਕੁਝ ਸੁਝਾਅ ਜਿਵੇਂ ਕਿ ਗਰਮੀਆਂ ਦੇ ਵਿੱਚ ਤਾਪਮਾਨ ਜ਼ਿਆਦਾ ਹੋਣ ਕਾਰਨ ਪਸੀਨੇ ਰਾਹੀਂ ਸਾਡੇ ਸਰੀਰ ਦਾ ਕਾਫੀ ਪਾਣੀ ਪਸੀਨੇ ਦੇ ਰੂਪ ਵਿੱਚ ਬਾਹਰ ਨਿਕਲ ਜਾਂਦਾ ਹੈ ਅਤੇ ਦੌੜਨ ਦੇ ਲਈ ਸਾਨੂੰ ਇਸ ਪ੍ਰਤੀ ਕਾਫੀ ਸੁਚੇਤ ਰਹਿਣ ਦੀ ਲੋੜ ਪੈਂਦੀ ਹੈ ਦੌੜ ਦੌੜਨ ਤੋਂ ਪਹਿਲਾਂ ਸਾਨੂੰ ਘੱਟੋ ਘੱਟ ਦੋ ਲੀਟਰ ਪਾਣੀ ਸਮੇਂ ਦੇ ਨਾਲ ਨਾਲ ਪੀਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਦੌੜ ਦੇ ਦੌਰਾਨ ਸਾਡੇ ਸਰੀਰ ਵਿੱਚ ਪਾਣੀ ਦੀ ਪੂਰਤੀ ਬਰਾਬਰ ਹੁੰਦੀ ਰਹੇ ਇਸ ਤਰ੍ਹਾਂ ਠੰਡ ਦੇ ਵਿੱਚ ਵੀ ਤਾਪਮਾਨ ਘੱਟ ਹੋਣ ਕਾਰਨ ਪਾਣੀ ਦੀ ਜ਼ਰੂਰਤ ਜ਼ਿਆਦਾ ਸਾਨੂੰ ਨਹੀਂ ਪੈਂਦੀ ਜਦਕਿ ਦੌੜ ਦੌੜਨ ਦੇ ਲਈ ਇੱਦਾਂ ਨਹੀਂ ਹੈ ਸਾਨੂੰ ਸਰਦੀਆਂ ਦੇ ਵਿੱਚ ਵੀ ਓਨਾ ਹੀ ਪਾਣੀ ਪੀਣਾ ਚਾਹੀਦਾ ਹੈ ਜਿੰਨਾ ਕਿ ਅਸੀਂ ਗਰਮੀਆਂ ਦੇ ਵਿੱਚ ਪੀਂਦੇ ਹਾਂ ਦੌੜ ਦੇ ਦੌਰਾਨ ਪਸੀਨੇ ਦੇ ਰਾਹੀਂ ਹੀ ਸਾਡੇ ਸਰੀਰ ਦਾ ਪਾਣੀ ਬਾਹਰ ਨਿਕਲਦਾ ਹੈ ਅਤੇ ਸਰੀਰ ਦੀ ਐਕਟੀਵਿਟੀ ਤੇਜ਼ ਹੋਣ ਕਾਰਨ ਸਾਡਾ ਸਰੀਰ ਵੀ ਹੌਲੀ ਹੌਲੀ ਥੱਕਦਾ ਰਹਿੰਦਾ ਹੈ ਦੌੜ ਦੌੜਨ ਦੇ ਲਈ ਸਾਨੂੰ ਐਨਰਜੀ ਦੀ ਪੂਰਤੀ ਵੀ ਨਾਲ ਨਾਲ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਬਰਸਾਤਾਂ ਵਿੱਚ ਵੀ ਸਾਨੂੰ ਆਪਣੇ ਕੱਪੜਿਆਂ ਅਤੇ ਬੂਟਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਵਾਟਰਪਰੂਫ ਹੋਣ ਅਤੇ ਸਾਡੇ ਬੂਟ ਜ਼ਿਆਦਾ ਸਲਿਪਰੀ ਨਾ ਹੋਣ ਸਾਨੂੰ ਨਵੇਂ ਬੂਟ ਬਰਸਾਤਾਂ ਵਿੱਚ ਜ਼ਿਆਦਾਤਰ ਯੂਜ ਕਰਨੇ ਚਾਹੀਦੇ ਹਨ ਤਾਂ ਜੋ ਸਲਿਪਰੀ ਜਗ੍ਹਾ 'ਤੇ ਪੈਰ ਫਿਸਲ ਕੇ ਸੱਟ ਲੱਗਣ ਤੋਂ ਅਸੀਂ ਬਚ ਸਕੀਏ ਇਸ ਤਰ੍ਹਾਂ ਬਦਲਦੇ ਮੌਸਮਾਂ ਦੇ ਵਿੱਚ ਦੌੜਨ ਦੀ ਪ੍ਰਕਿਰਿਆ ਅਲੱਗ ਅਲੱਗ ਹੁੰਦੀ ਹੈ ਧੰਨਵਾਦ